ਪੰਜਾਬ ਵਿੱਚ ਕਾਰੋਬਾਰੀ ਮਾਹੌਲ ਉੱਦਮਤਾ ਅਤੇ ਨਵੀਨਤਾ ਦਾ ਸਮਰਥਨ ਪੰਜਾਬ ਦੇ ਵਪਾਰਕ ਅਤੇ ਉਦਯੋਗਿਕ ਮਾਹੌਲ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਕਈ ਤਰੀਕੇ ਹਨ ਜਿਵੇਂ ਮਾਈਕਰੋਸੋਫਟ ਇੰਟਰਪ੍ਰਾਈਜਿਸ ਸਟਾਰਟ ਅਪਸ ਡਿਜੀਟਲ ਇੰਡੀਆ ਅਤੇ ਮੇਕ ਇਨ ਪੰਜਾਬ ਵਰਗੀਆਂ ਪਹਿਲ ਕਦਮੀਆਂ ਨਾਲ ਨਵੀਆਂ ਵਿਧਾ ਸੰਭਾਵਨਾਵਾਂ ਵੱਧ ਰਹੀਆਂ ਹਨ ਉਦਯੋਗਿਕ ਢਾਂਚਾ ਜਿਵੇਂ ਐਮ ਐਸ ਐਮ ਈ ਅਤੇ ਮਾਈ ਮੈਨੂਫੈਕਚਰਿੰਗ ਹੱਬ ਲੁਧਿਆਣਾ ਜਲੰਧਰ ਅੰਮ੍ਰਿਤਸਰ ਮੋਹਾਲੀ ਇਹ ਸ਼ਹਿਰ ਟੈਕਸਟਾਈਲ ਆਟੋ ਪਾਰਟ ਸਪੋਰਟ ਗੁੱਡਜ਼ ਐਂ ਅਤੇ ਹੈਂਡ ਟੂਲ ਮੈਨੂਫੈਕਰਰਿੰਗ ਲਈ ਮਸ਼ਹੂਰ ਹਨ ਪੰਜਾਬ ਸਮੋਲ ਸਕੇਲ ਇੰਡਸ ਇੰਡਸਟਰੀ ਪੋਲਸੀ ਕੈਰੋ ਕਾਰੋਬਾਰ ਵਧਾਉਣ ਲਈ ਮਦਦ ਕਰਦੀ ਹੈ ਜਿਵੇਂ ਆਈ ਟੀ ਅਤੇ ਸਟਾਰਟ ਅਪਸ ਈਕੋਸਿਸਟਮ ਮੋਹਾਲੀ ਪੰਜਾਬ ਦਾ ਸਿਲੀਕੋਨ ਵੈਲੀ ਬਣ ਰਿਹਾ ਹੈ ਐਗਰੀਕਲਚਰ ਅਤੇ ਐਗਰੀ ਟੈਕ ਇਨੋਵੇਸ਼ਨ ਐਗਰੀ ਟੈਕ ਸਟਾਰਟ ਅਪਸ ਖੇਤੀ ਵਿੱਚ ਨਵੀਨਤਾ ਨੂੰ ਅੱਗੇ ਵਧ ਵਧਾ ਰਿਹਾ ਹੈ